ਫਤਿਹਗੜ੍ਹ ਸਾਹਿਬ ਵਿਖੇ ਇੱਕ ਤਾਂ ਇੰਜੀਨੀਅਰਿੰਗ ਕੋਲਜ ਹੈ ਇੱਕ ਮਾਤਾ ਗੁਜਰੀ ਕੋਲਜ ਹੈ ਅਤੇ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਹੈ ਇਹ ਜਿਹੜੀਆਂ ਤਿੰਨੇ ਸੰਸਥਾਵਾਂ ਨੇ ਨਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਰੱਸਟ ਬਣੇ ਹੋਏ ਨੇ ਉਹਨਾਂ ਦੇ ਅੰਡਰ ਚੱਲਦੀਆਂ ਨੇ ਅਤੇ ਤਿੰਨਾਂ ਦੇ ਵਿੱਚ ਵੱਡੇ ਵੱਡੇ ਸਟੇਡੀਅਮ ਬਣੇ ਹੋਏ ਨੇ ਜਿਵੇਂ ਕ੍ਰਿਕਟ ਦੇ ਜੇ ਮੈਚ ਹੁੰਦੇ ਆ ਤਾਂ ਮਾਤਾ ਗੁਜਰੀ ਕੋਲਜ ਦੇ ਵਿੱਚ ਕਰਵਾਏ ਜਾਂਦੇ ਨੇ ਕੋਈ ਸਪੋਰਟਸ ਦੇ ਰਿਲੇਟਡ ਐਥਲੈਟਿਕਸ ਦੇ ਰਿਲੇਟਡ ਮੈਚ ਹੁੰਦੇ ਨੇ ਤਾਂ ਉਹ ਇੱਧਰ ਆਪਣੇ ਬੰਦਾ ਸਿੰਘ ਬਹਾਦਰ ਕੋਲਜ ਜਾਂ ਤਿੰਨਾਂ 'ਚੋਂ ਕਿਸੇ ਵੀ ਇੰਸਟੀਟਿਊਟ 'ਚ ਕਰਵਾ ਲਏ ਜਾਂਦੇ ਨੇ ਅਤੇ ਜੇ ਬੈਡਮਿੰਟਨ ਦੀ ਗੱਲ ਕਰੀਏ ਤਾਂ ਉਹਦਾ ਕੋਟ ਬੈਡਮਿੰਟਨ ਕੋਰਸ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕੋਲਜ ਦੇ ਵਿੱਚ ਨੇ ਅਤੇ ਜਿਹੜੇ ਹੋਰ ਬਾਕੀ ਦੇ ਖੇਡਾਂ ਦੇ ਕੋਟ ਹੈਗੇ ਉਹ ਯੂਨੀਵਰਸਿਟੀ ਦੇ ਵਿੱਚ ਵੀ ਹੈਗੇ ਸੋ ਕੁੱਲ ਮਿਲਾ ਕੇ ਕੀ ਹੈ ਕਿ ਹਰ ਇੱਕ ਤਰ੍ਹਾਂ ਦੀ ਗੇਮ ਦਾ ਜਿਹੜਾ ਹੈਗਾ ਪ੍ਰਬੰਧ ਹੈਗਾ ਖੇਡਣ ਦਾ ਅਤੇ ਬੜੀ ਈਜ਼ੀਲੀ ਰੀਚੇਬਲ ਹੈ ਕਿਉਂਕਿ ਬੜਾ ਛੋਟਾ ਸ਼ਹਿਰ ਹੋਣ ਕਰਕੇ ਕੋਈ ਜ਼ਿਆਦਾ ਦੂਰ ਨਹੀਂ ਹੈ ਕਿ ਜੇ ਆਪਾਂ ਬਸ ਸਟੈਂਡ ਦੀ ਵੀ ਗੱਲ ਕਰੀਏ ਤਾਂ ਪੰਜ ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕਿਉਂਕਿ ਇਹ ਤਿੰਨੇ ਇੰਸਟੀਚਿਊਟ ਨੇੜੇ ਨੇੜੇ ਨੇ ਪੰਜ ਕਿਲੋਮੀਟਰ ਪੈਂਦਾ ਤਕਰੀਬਨ ਬਸ ਸਟੈਂਡ ਤੋਂ ਅਤੇ ਕੋਈ ਵੀ ਬੰਦਾ ਪਹੁੰਚ ਸਕਦਾ ਛੋਟਾ ਸ਼ਹਿਰ ਹੋਣ ਕਰਕੇ ਸਾਰਿਆਂ ਲਈ ਇਹ ਪਹੁੰਚਣਯੋਗ ਨੇ ਅਤੇ ਉਪਲਬਧ ਨੇ